ਅੱਜ ਕੱਲ੍ਹ ਤਾਂ ਪੰਜਾਬ ਵਿੱਚ ਰਹਿਣ ਵਾਸਤੇ ਬੜੇ ਹੀ ਤਕੜੇ ਤਕੜੇ ਹੋਟਲ ਬਣ ਚੁੱਕੇ ਹਨ ਬੜੇ ਹੀ ਜ਼ਿਆਦਾ ਫਾਈਵ ਸਟਾਰ ਹੋਟਲ ਵੀ ਬਣਨੇ ਸ਼ੁਰੂ ਹੋ ਗਏ ਹਨ ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇਹ ਵੀ ਹੈ ਕਿ ਅੱਜ ਕੱਲ੍ਹ ਪੰਜਾਬ ਵਿਚ ਮੈਚ ਹੋਣੇ ਸ਼ੁਰੂ ਹੋ ਗਏ ਹਨ ਬਾਹਰ ਦੇ ਬੜੇ ਚਰਨ ਲੋਕ ਵੀ ਆਉਣੇ ਸ਼ੁਰੂ ਹੋ ਗਏ ਹੋ ਗਏ ਹਨ ਜਿਸ ਕਾਰਨ ਹੋਟਲਾਂ ਦੀ ਕਮਾਈ ਹਰ ਦਿਨ ਅਤੇ ਹਰ ਸਾਲ ਵਧੀ ਜਾ ਰਹੀ ਹੈ ਲੋਕ ਤਾਂ ਬਹੁਤ ਹੀ ਖੁਸ਼ ਹੁੰਦੇ ਹਨ ਲੋਕ ਬਾਹਰ ਦੇ ਲੋਕਾਂ ਨੂੰ ਦੇਖ ਕੇ ਅਤੇ ਹੋਟਲ ਵਾਲੇ ਉਹ ਤੋਂ ਵੀ ਜ਼ਿਆਦਾ ਖੁਸ਼ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਇੱਕ ਕਮਾਈ ਕਰਨ ਦਾ ਸਾਧਾ ਸਾਧਨ ਮਿਲ ਗਿਆ ਹੈ ਅਤੇ ਇਕ ਕਮਾਈ ਕਰਨ ਦੀ ਵਜ੍ਹਾ ਜ਼ਿਆਦਾ ਵਜ੍ਹਾ ਆਹ ਵੀ ਹਨ ਕਿ ਲੋਕ ਭਾਰਤ ਵਿੱਚ ਅਮੀਰ ਵੀ ਹੋਈ ਜਾ ਰਹੇ ਹਨ ਅਤੇ ਲੋਕ ਹੁਣ ਸਮਝਦੇ ਹਨ ਕਿ ਪੈਸਾ ਬਚਾਉਣ ਤੋਂ ਚੰਗਾ ਇਸ ਨੂੰ ਵਰਤੋ ਅਤੇ ਖੁਸ਼ ਰਹੋ ਜ਼ਿੰਦਗੀ ਵਿੱਚ ਹਰ ਇੱਕ ਲੋਕ ਕਹਿੰਦੇ ਹਨ ਕਿ ਹਰ ਇੱਕ ਚੀਜ਼ ਦਾ ਮਜ਼ਾ ਲੈਣਾ ਚਾਹੀਦਾ ਹੈ ਭਈ ਉਹ ਤਾਂ ਕਿਤੇ ਘੁੰਮਣਾ ਹੋਏ ਜਾਂ ਕੋਈ ਹੋਟਲ ਵਿੱਚ ਜਾਣਾ ਏ ਜਾਂ ਕੋਈ ਫਾਈਵ ਸਟਾਰ ਹੋਟਲ ਦੇ ਵਿੱਚ ਰਹਿਣਾ ਹੋਵੇ ਭਾਵੇਂ ਪੰਜਾਬ ਵਿੱਚ ਫਾਈਵ ਸਟਾਰ ਹੋਟਲ ਦੇ ਨਾਲ ਨਾਲ ਬੜੇ ਜ਼ਿਆਦਾ ਛੋਟੇ ਹੋਟਲ ਵੀ ਬਣਨੇ ਸ਼ੁਰੂ ਹੋ ਗਏ ਹਨ ਜਿਹ ਜਿਹਦੇ ਹਰ ਇੱਕ ਓਹ ਹਰ ਇੱਕ ਲੈਵਲ ਦੇ ਲੋਕਾਂ ਵਾਸਤੇ ਹਨ ਕਿ ਕੋਈ ਗਰੀਬ ਲੋਕ ਵੀ ਰਹਿ ਸਕਦੇ ਹਨ ਅਤੇ ਕੋਈ ਅਮੀਰ ਲੋਕ ਵੀ ਰਹਿ ਸਕਦੇ ਹਨ ਲੋਕ ਅੱਜ ਕੱਲ੍ਹ ਹਰ ਦੁਨੀਆਂ ਵੀ ਵਿੱਚ ਜਾਂਦੇ ਹਰ ਇੱਕ ਦੇਸ਼ ਵਿੱਚ ਜਾਂਦੇ ਹਨ ਅਤੇ ਲੋਕ ਸਮਝਦੇ ਹਨ ਕਿ ਬਾਹਰ ਤਾਂ ਸਿਰਫ ਮਹਿੰਗੀ ਚੀਜ਼ਾਂ ਹੀ ਹਨ ਪਰ ਭਾਰਤ ਵਿੱਚ ਵਿੱਚ ਅੱਜ ਕੱਲ੍ਹ ਬੜੇ ਜ਼ਿਆਦਾ ਵਿਕਲ ਵਿਲ ਵਿਕਲਪ ਪੈਦਾ ਹੋ ਗਏ ਹਨ